ਭਾਰਤ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਹੀ ਪਾਰਟੀਆਂ ਹਨ ਜਿਹਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਆਰ ਐੱਸ ਐੱਸ ਆਦਿ ਅਤੇ ਹੋਰ ਵੀ ਕਈ ਪਾਰਟੀਆਂ ਹਨ ਇਹ ਪਰ ਮੈਂ ਇਹਨਾਂ ਦੇ ਪ੍ਰਮੁੱਖ ਉਸ ਚੀਜ਼ ਦਾ ਵਰਣਨ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇਹਨਾਂ ਨੇ ਪਾਰਟੀਆਂ ਵਿੱਚ ਜ਼ਿਆਦਾ ਇੰਟਰਸਟ ਨਹੀਂ ਹੈਗਾ ਵੀ ਹਰ ਇੱਕ ਦੇ ਅਤੇ ਠੀਕ ਹੈ ਜਦੋਂ ਵੋਟਾਂ ਆਉਂਦੀਆਂ ਹਨ ਤਾਂ ਅਸੀਂ ਵੋਟਾਂ ਪਾਉਣ ਵਾਸਤੇ ਜਾਂਦੇ ਹਾਂ ਪਰ ਆਪਣਾ ਫਰਜ਼ ਅਦਾ ਕਰਦੇ ਹਨ ਅਸੀਂ ਤਾਂ ਕਿ ਅਸੀਂ ਕਹਿੰਦੇ ਹਾਂ ਵੋਟਿੰਗ ਪਾ ਕੇ ਵੀ ਜਿਸਦੇ ਜਿਹੜਾ ਵੀ ਉਸ ਵੇਲੇ ਦੇਖੀਦਾ ਵੀ ਜਿਹੜਾ ਵੀ ਅੱਛਾ ਕੰਮ ਕਰ ਰਿਹਾ ਹੈ ਸਮਾਜ ਵਿੱਚ ਉਹਨੂੰ ਵੋਟ ਦੇ ਕੇ ਵੋਟ ਦੇ ਕੇ ਅਸੀਂ ਆਉਂਦੇ ਹਾਂ ਤਾਂ ਕਿ ਉਹ ਆਉਣ ਵਾਲੇ ਵਿੱਚ ਚੰਗਾ ਨੇਤਾ ਬਣੇ ਚੰਗਾ ਨੇਤਾ ਬਣੇਗਾ ਅਤੇ ਚੰਗੇ ਕੰਮ ਕਰੇਗਾ ਤਾਂ ਸਮਾਜ ਦੀ ਤਰੱਕੀ ਹੋਵੇਗੀ ਦੇਸ਼ ਨੂੰ ਉੱਪਰ ਲਿਜਾਉਣ ਵਿੱਚ ਉਹ ਚੰਗਾ ਰੋਲ ਅਦਾ ਕਰੇ ਅਗਰ ਉਹ ਹੀ ਨਹੀਂ ਕਰਦਾ ਤਾਂ ਅਗਲੀ ਵਾਰੀ ਵੋਟਾਂ ਨੂੰ ਤੁਸੀਂ ਦੇਖਦੇ ਹੋ ਕਿ ਹਰ ਕੋਈ ਆਦਮੀ ਜੋ ਨਹੀਂ ਕੋਈ ਚੰਗਾ ਕੰਮ ਕਰੇਗਾ ਤਾਂ ਉਹ ਰਿਵਰਸ ਰਿਵਰਸ ਵੋਟ ਜਾ ਕੇ ਉਹਨੂੰ ਥੱਲੇ ਵੀ ਉਤਾਰ ਸਕਦਾ ਹੈ ਇਹ ਅਤੇ ਇੱਕ ਆਹ ਹਰ ਇੱਕ ਆਦਮੀ ਦੇ ਹੱਥ ਵਿੱਚ ਹੈ ਆਮ ਆਦਮੀ ਦੇ ਹੱਥ ਵਿੱਚ ਹੈ ਕਿ ਉਹ ਵੋਟ ਪਾ ਕੇ ਚ ਚੰਗੇ ਆਦਮੀ ਨੂੰ ਉੱਪਰ ਲਿਜਾਵੇ ਅਤੇ ਜੇ ਉਹ ਤਾਂ ਕਿ ਦੇਸ਼ ਦਾ ਨਾਂ ਉਹ ਨੇਤਾ ਦੇਸ਼ ਦਾ ਨਾਂ ਰੋਸ਼ਨ ਕਰ ਸਕੇ ਧੰਨਵਾਦ